ਪਹਿਲਾਂ ਤਾਂ ਸਾਡੇ ਪਿੰਡ ਦੀਆਂ ਔਰਤਾਂ ਸਾਰਾ ਹੀ ਮਸਾਲਿਆਂ ਦਾ ਸਮਾਨ ਇਕੱਠਾ ਕਰਦੀਆਂ ਹਨ ਅਤੇ ਉਹਨਾਂ ਨੂੰ ਸੁਕਾਉਂਦੀਆਂ ਹਨ ਅਤੇ ਚੰਗੀ ਤਰ੍ਹਾਂ ਤਿਆਰ ਕਰਦੀਆਂ ਹਨ ਜਦੋਂ ਤੱਕ ਉਹ ਸੁੱਕ ਕੇ ਪੀਸਣ ਦੇ ਕਾਬਲ ਨਹੀਂ ਹੋ ਜਾਂਦਾ ਜਦੋਂ ਉਹ ਪੀਸਣ ਦੇ ਕਾਬਲ ਹੋ ਜਾਂਦਾ ਹੈ ਫਿਰ ਮਹੀ ਹਫਤੇ ਦੇ ਅਖੀਰਲੇ ਦਿਨ ਸ਼ਨੀਵਾਰ ਅਤੇ ਐਤਵਾਰ ਇਹ ਦੋ ਦਿਨਾਂ ਵਿੱਚ ਉਹ ਆਪਣਾ ਸ ਸਾਰਾ ਮਸਾਲੇ ਦਾ ਸਮਾਨ ਲੈ ਕੇ ਇੱਕ ਜਗ੍ਹਾ ਇਕੱਠੀਆਂ ਹੁੰਦੀਆਂ ਹਨ ਅਤੇ ਉੱਥੇ ਇੱਕ ਦੂਜੇ ਦੀ ਸਹਾਇਤਾ ਕਰਦੀਆਂ ਹੋਈਆਂ ਉਹਨਾਂ ਨੂੰ ਪੀਸਦੀਆਂ ਹਨ ਅਤੇ ਇੱਕ ਇੱਕ ਦੂਜੇ ਦੀ ਮਦਦ ਕਰਦੇ ਹੋਏ ਏਕਤਾ ਦਾ ਬਲ ਦਿਖਾਉਂਦੇ ਹੋਏ ਉਹ ਆਪਣਾ ਕੰਮ ਜਲਦ ਤੋਂ ਜਲਦ ਨਿਬੇੜ ਕੇ ਆਪੋ ਆਪਣੇ ਘਰਾਂ ਜਾਂਦੀਆਂ ਹਨ ਅਤੇ ਉਹਨਾਂ ਦੇ ਪੀਸੇ ਹੋਏ ਮਸਾਲਿਆਂ ਦੀ ਬਹੁਤ ਹੀ ਵਧੀਆ ਅਤੇ ਅਸਰਦਾਰ ਹੁੰਦੇ ਹਨ